ਸ਼ੁਰੂ ਤੋਂ ਹੀ ਇੱਕ ਪਰਿਵਾਰ ਦਾ ਮੁਖੀ ਇੱਕ ਆਦਮੀ ਹੀ ਬਣਦਾ ਆਇਆ ਹੈ ਅਤੇ ਬਣ ਵੀ ਰਿਹਾ ਹੈ ਕਿਉਂਕਿ ਉਹ ਸਾਰੇ ਘਰ ਨੂੰ ਚਲਾਉਂਦਾ ਹੈ ਉਸਨੂੰ ਲਾਣੇਦਾਰ ਵੀ ਕਹਿੰਦੇ ਹਨ ਉਹ ਉਹ ਔਰਤਾਂ ਨੂੰ ਸਿਰਫ਼ ਆਪਣੇ ਪੈਰ ਦੀ ਜੁੱਤੀ ਸਮਝਦੇ ਸਮਝਦੇ ਸੀ ਅਤੇ ਉਹਨਾਂ ਨੂੰ ਬਸ ਸਿਰਫ਼ ਘਰ ਦਾ ਹੀ ਕੰਮ ਕਰਨ ਲਈ ਕਹਿੰਦੇ ਸਨ ਬਾਹਰ ਨਿਕਲਣ ਤੋਂ ਔਰਤਾਂ ਨੂੰ ਮਨਾਹੀ ਕੀਤੀ ਜਾਂਦੀ ਸੀ ਪਰ ਅੱਜ ਕੱਲ੍ਹ ਦੇ ਮੋਡਰਨ ਜਮਾਨੇ ਵਿੱਚ ਔਰਤਾਂ ਮਰ ਮਰਦਾਂ ਤੋਂ ਦੋ ਕਦਮ ਅੱਗੇ ਚੱਲ ਰਹੀਆਂ ਸਨ ਅੱਜ ਕੱਲ੍ਹ ਦੇ ਔਰਤਾਂ ਮਰਦਾਂ ਦੇ ਬਰਾਬਰ ਕੰਮ ਕਰ ਰਹੀਆਂ ਸਨ ਖੇਤਾਂ ਵਿੱਚ ਵੀ ਉਨ੍ਹਾਂ ਦੇ ਨਾਲ ਹੀ ਕੰਮ ਕਰਨ ਜਾਂਦੀਆਂ ਸਨ ਉਹ ਦੋਵੇਂ ਕੰਮ ਨੂੰ ਵੰਡ ਕੇ ਕਰਦੇ ਸਨ ਉਹ ਘਰ ਦਾ ਔਰਤਾਂ ਘਰ ਦਾ ਕੰਮ ਕਰਨ ਦੇ ਨਾਲ ਨਾਲ ਬਾਹਰ ਦਾ ਕੰਮ ਵੀ ਕਰ ਰਹੀਆਂ ਸਨ ਅੱਜ ਕੱਲ੍ਹ ਦੇ ਮੋਡਰਨ ਜਮਾਨੇ ਵਿੱਚ ਵਿੱਚ ਸਾਰੀਆਂ ਚੀਜ਼ਾਂ ਦਾ ਵਿਕਾਸ ਹੋ ਰਿਹਾ ਹੈ ਅਤੇ ਹੋ ਵੀ ਗਿਆ ਹੈ ਔਰਤਾਂ ਮਰਦਾਂ ਦੇ ਬਰਾਬਰ ਚੱਲ ਰਹੀਆਂ ਸਨ ਅਤੇ ਅੱਜ ਕੱਲ੍ਹ ਦੀਆਂ ਔਰਤਾਂ ਆਵਾਜਾਈ ਦੇ ਸਾਧਨਾਂ ਨੂੰ ਵੀ ਚਲਾ ਰਹੀਆਂ ਸਨ